ਮੈਂ ਗੁਪਤਾ ਮਨਿਆਰੀ ਦੀ ਦੁਕਾਨ ਤੋਂ ਆਪਣੇ ਬਾਲਾਂ ਲਈ ਆਪਣੀ ਸਹੇਲੀ ਦੇ ਕਹੇ 'ਤੇ ਪਹਿਲੀ ਵਾਰ ਇੱਕ ਹੇਅਰ ਔਇਲ ਖਰੀਦਿਆ ਸੀ ਪਰ ਜਿਸ ਬਾਲਾਂ ਦੀ ਚੜਨ ਦੀ ਮੁਸ਼ਕਲ ਨੂੰ ਇਹ ਤੇਲ ਲਿਆ ਸੀ ਮੈਨੂੰ ਇਸ ਦਾ ਕੋਈ ਫਾਇਦਾ ਨਹੀਂ ਦਿੱਸ ਰਿਹਾ ਸਗੋਂ ਇਸ ਨੇ ਮੇਰੇ ਬਾਲ ਰੁੱਖੇ ਅਤੇ ਹੋਰ ਝਾੜ ਦਿੱਤੇ ਹਨ ਇਸਦੀ ਇੰਨੀ ਕੀਮਤ ਦੇਣ ਦੇ ਬਾਵਜੂਦ ਮੈਨੂੰ ਇਸ ਦਾ ਕੋਈ ਨਤੀਜਾ ਨਹੀਂ ਮਿਲਿਆ ਮੇਰੇ ਲਈ ਇਸ ਤੇਲ ਦਾ ਅਨੁਭਵ ਬਿਲਕੁਲ ਚੰਗਾ ਨਹੀਂ ਰਿਹਾ